ਮੈਂ ਜਾਂ ਮੇਰੇ ਦੋਸਤ ਨੇ ਜਦੋਂ ਵੀ ਅਸੀਂ ਕਿਸੇ ਯਾਤਰਾ 'ਤੇ ਜਾਂ ਕਿਸੇ ਵੀ ਸੈਰ ਸਪਾਟੇ 'ਤੇ ਜਾਣਾ ਹੋਵੇ ਉਸ ਤੋਂ ਪਹਿਲਾਂ ਸਾਡੀ ਇੱਕ ਯੋਜਨਾ ਬੰਦੀ ਕੀਤੀ ਜਾਂਦੀ ਆ ਅਸੀਂ ਸਮੁੱਚੀ ਉਸ ਯਾਤਰਾ ਦੇ ਪੀਰੀਅਡ ਨੂੰ ਕਾਲ ਨੂੰ ਸਮੇਂ ਨੂੰ ਵੰਡਦੇ ਹਾਂ ਅਤੇ ਨਿਰਧਾਰਤ ਤਰੀਕਾਂ ਮਿਤੀਆਂ ਸਮੇਂ ਦੇ ਵਿੱਚ ਉਸ ਸਮੁੱਚੀ ਯਾਤਰਾ ਨੂੰ ਵੰਡ ਲੈਂਦੇ ਹਾਂ ਅਤੇ ਅੱਗੇ ਨਾਲ ਲੈ ਜਾਣ ਵਾਲੀਆਂ ਜ਼ਰੂਰੀ ਵਸਤਾਂ ਜੋ ਜੋ ਸਾਡੀਆਂ ਲੋੜੀਂਦੀਆਂ ਨੇ ਜਿਹੜੀਆਂ ਜ਼ਰੂਰੀ ਨੇ ਉਹਨਾਂ ਦਾ ਖਾਸ ਪ੍ਰਬੰਧ ਕਰਕੇ ਤੁਰਦੇ ਹਾਂ ਅੱਗੇ ਵੀ ਜਿੱਥੇ ਜਿੱਥੇ ਵੀ ਅਸੀਂ ਜਾਣਾ ਉੱਥੇ ਵੀ ਜਾਣ ਤੋਂ ਪਹਿਲਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡਾ ਸੰਪਰਕ ਹੋਵੇ ਉਥੋਂ ਦੇ ਲੋਕਾਂ ਦੇ ਨਾਲ ਸਾਡਾ ਕੋਈ ਤਾਲਮੇਲ ਹੋ ਸਕੇ ਜਿਸ ਕਰਕੇ ਸਾਨੂੰ ਕਿਸੇ ਤਰੀਕੇ ਦੀ ਜਿਹੜੀ ਆ ਉਹ ਮੁਸ਼ਕਿਲ ਨਾ ਆਵੇ ਅਤੇ ਸਾਡੀ ਇਹੋ ਯਤਨ ਹੁੰਦਾ ਕਿ ਕੋਈ ਵੀ ਕੰਮ ਕਰਨਾ ਜਾਂ ਕੋਈ ਵੀ ਯਾਤਰਾ ਕਰਨੀ ਅਤੇ ਉਹ ਇੱਕ ਸਿਸਟਮੈਟਿਕਲੀ ਹੋਵੇ ਉਹਦੀ ਯੋਜਨਾ ਬੰਦੀ ਬੜੇ ਤਰੀਕੇ ਦੇ ਨਾਲ ਕੀਤੀ ਜਾਵੇ ਉਸ ਤਰੀਕੇ ਦੇ ਵਿੱਚ ਸਾਡੇ ਅਹਿਮ ਪਹਿਲੂ ਕਿ ਵੀ ਜਿੱਥੇ ਜਾ ਕੇ ਅਸੀਂ ਟਿਕਾਣਾ ਕਰਨਾ ਰਹਿਣਾ ਉਹਦਾ ਪ੍ਰਬੰਧ ਹੋਵੇ ਉੱਥੇ ਖਾਣ ਪੀਣ ਦਾ ਜਿਹੜਾ ਭੋਜਨ ਦਾ ਪ੍ਰਬੰਧ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਅਸੀਂ ਸਮੇਂ ਤੋਂ ਪਹਿਲਾਂ ਜਿਹੜਾ ਵਾ ਉਹ ਆਪਣੇ ਧਿਆਨ ਦੇ ਵਿੱਚ ਰੱਖ ਕੇ ਚੱਲਦੇ ਹਾਂ ਜਿਹਦੇ ਕਰਕੇ ਸਾਡੀ ਯਾਤਰਾ ਜਿੰਨੀ ਵਾਰੀ ਵੀ ਅਸੀਂ ਗਏ ਹਾਂ ਬੜੀ ਸੁਰੱਖਿਅਤ ਰਹੀ ਆ ਬੜੀ ਆਰਾਮਦਾਇਕ ਰਹੀ ਆ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਸਾਨੂੰ ਨਹੀਂ ਕਰਨਾ ਪਿਆ ਯੋਜਨਾ ਬੰਦੀ ਕਰਕੇ ਤੁਰਨਾ ਬੜਾ ਅਹਿਮ ਆ